ਮੋਹਾਲੀ ਜ਼ਿਲ੍ਹੇ ਵਿੱਚ ਜ਼ਿਆਦਾਤਰ ਲੋਕ ਮਿਕਸ ਬੋਲੀ ਬੋਲਦੇ ਹਨ ਜਿਸ ਨੂੰ ਮਿਲਾ ਕੇ ਆਪਣਾ ਪੁਆਧੀ ਅਤੇ ਮਲਵਈ ਇਹ ਦੋਨੇ ਬੋਲੀਆਂ ਮਿਕਸ ਕਰਕੇ ਬੋਲੀਆਂ ਜਾਂਦਾ ਹਨ ਕਿਤੇ ਕਿਤੇ ਤਾਂ ਇੱਧਰ ਆਪਣਾ ਬਨੂੜ ਵੱਲ ਇੱਧਰ ਮੋਹਾਲੀ ਭਾਗੋ ਮਾਜਰਾ ਹੋ ਗਿਆ ਉਰੇ ਪੁਆਧੀ ਜ਼ਿਆਦਾ ਪਿਓਰ ਬੋਲੀ ਜਾਂਦੀ ਹੈ ਅਤੇ ਇੱਧਰ ਆਪਣਾ ਮੋਹਾਲੀ ਤੋਂ ਇੱਧਰਲੇ ਰੂਪਨਗਰ ਵਾਲੇ ਪਾਸੇ ਮਲਵਈ ਅਤੇ ਪੁਆਧੀ ਬੋਲੀ ਜਾਂਦੀ ਹੈ ਮਿਕਸ ਕਰਕੇ ਬੋਲੀ ਜਾਂਦੇ ਅਤੇ ਮੋਹਾਲੀ ਜ਼ਿਲ੍ਹੇ ਵਿੱਚ ਹਰੇਕ ਕਿਸਮ ਦਾ ਬੰਦਾ ਰਹਿੰਦਾ ਹੈ ਹੈ ਜਿਸ ਵਿੱਚ ਸਾਰੇ ਹੀ ਆ ਜਾਂਦੇ ਹਨ ਉੱਪਰ ਜਾਤੀਆਂ ਨੀਚੇ ਜਾਤੀਆਂ ਸਾਰੀਆਂ ਹੀ ਆ ਜਾਂਦੀਆਂ ਨੇ ਕਬੀਲੇ ਵਾਸੀ ਸਭ ਆ ਜਾਂਦੇ ਹਨ ਅਤੇ ਇਸ ਵਿੱਚ ਜ਼ਿਆਦਾਤਰ ਖੇਤੀ ਵੀ ਕੀਤੀ ਜਾਂਦੀ ਹੈ